ਸ਼ਹੀਦ ਭਗਤ ਸਿੰਘ ਜ਼ਿਲ੍ਹੇ ਜ਼ਿਲ੍ਹੇ ਵਿੱਚ ਸਾਰੇ ਹੀ ਤਿਉਹਾਰ ਬੜੇ ਧੂਮਧਾਮ ਅਤੇ ਸ਼ਾਨੋ ਸ਼ੋਕਤ ਨਾਲ ਮਨਾਏ ਜਾਂਦੇ ਹਨ ਜਿੱਦਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਗੁਰਪੁਰਬ ਗੁਰ ਜਿਹੜੇ ਵੀ ਗੁਰੂ ਦਾ ਗੁਰਪੁਰਬ ਹੋਵੇ ਸਾਰੇ ਹੀ ਬੜੇ ਧੂਮਧਾਮ ਨਾਲ ਮਨਾਏ ਜਾਂਦੇ ਹਨ ਪਾਠ ਹੁੰਦੇ ਨੇ ਨਗਰ ਕੀਰਤਨ ਨਿਕ ਸਜਾਏ ਜਾਂਦੇ ਨੇ ਕੀਰਤਨ ਲੰਗਰ ਵਰਤਦੇ ਨੇ ਇਸ ਤੋਂ ਬਾਅਦ ਗੱਲ ਕਰੀਏ ਤਾਂ ਦੀਵਾਲੀ ਦੀਵਾਲੀ ਵਾਲੇ ਦਿਨ ਸ਼੍ਰੀ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਤੇ ਕਤੇ ਸ਼੍ਰੀ ਗੁਰੂ ਹਰਗੋਬਿੰਦ ਸੀ ਜੀ ਸਿੰਘ ਜੀ ਨੇ ਕਈ ਕੈਦੀਆਂ ਨੂੰ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਕਰਵਾਇਆ ਸੀ ਜਿਸ ਕਰਕੇ ਦੀਵਾਲੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਤੋਂ ਬਾਅਦ ਲੋਹੜੀ ਲੋਹੜੀ ਵਾਲੇ ਦਿਨ ਲੋਕ ਲੋਕ ਕੁਛ ਨਾ ਕੁਛ ਜਿਸ ਤਰ੍ਹਾਂ ਕੁਛ ਨਾ ਕੁਛ ਖਾਣ ਨੂੰ ਬਣਾਉਂਦੇ ਨੇ ਵਧੀਆ ਤਰੀਕੇ ਨਾਲ ਧੂਮਧਾਮ ਨਾਲ ਸ਼ੋਪਿੰਗ ਕੀਤੀ ਜਾਂਦੀ ਹੈ ਸ਼ਾਮ ਦੇ ਟਾਈਮ ਲੋਹੜੀ ਬਾਲੀ ਜਾਂਦੀ ਹੈ ਜਿਸ ਵਿੱਚ ਮੂੰਗਫਲੀ ਰਿਉੜੀਆਂ ਸਾਰਾ ਕੁਛ ਪਾ ਕੇ ਅੱਗ ਵਿੱਚ ਪਾ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਵਿਸਾਖੀ ਵਿਸਾਖੀ ਵਾਲੇ ਦਿਨ ਵੀ ਸ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਾਦੇ ਸਾਜਨਾ ਕੀਤੀ ਸੀ ਇਸ ਦਿਨ ਪੰਜਾਂ ਪਿਆਰਿਆਂ ਨੂੰ ਗੁਰੂ ਗ੍ਰੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਉਹਨਾਂ ਕੋਲੋਂ ਆਪ ਅੰਮ੍ਰਿਤ ਛਕ ਕੇ ਗ ਖਾਲਸਾ ਪੰਥ ਦੀ ਸਜ ਸਾਜਨਾ ਕੀਤੀ ਸੀ